ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀ ਮਨਮੀਤ ਬੋਲ ਰਹੇ ਹੋ ਹਾਂਜੀ ਮੈਮ ਮੈਂ ਕਮਲਪ੍ਰੀਤ ਬੋਲ ਰਹੀ ਹਾਂ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਤੁਸੀਂ ਇਸਟਾਗ੍ਰਾਮ 'ਤੇ ਵੀਡੀਓ ਬਣਾਉਂਦੇ ਆ ਨਾ ਹਾਂਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਆਂ ਮੈਨੂੰ ਤੁਹਾਡੀ ਹਰ ਇੱਕ ਵੀਡੀਓ ਜਿਹੜੀ ਹੈ ਨਾ ਉਹ ਇੱਕ ਰੀਜਨੇਬਲ ਹੁੰਦੀ ਆ ਮਤਲਬ ਉਹਦੇ ਵਿੱਚ ਕੋਈ ਨਾ ਕੋਈ ਸ਼ੋਸ਼ਲ ਮੈਸ਼ਿਜ ਦਿੱਤਾ ਹੁੰਦਾ ਆ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਪਸੰਦ ਆ ਹਾਂਜੀ ਬਿਲਕੁਲ ਤੁਸੀਂ ਸਾਡੀ ਜਿਹੜੀਆਂ ਵੀਡੀਓ ਚਾਈਲਡ ਨਾਲ ਰਿਲੇਟਡ ਗਰਲ ਚਾਈਲਡ ਨਾਲ ਰਿਲੇਟਡ ਆ ਉਹਨਾਂ ਨੂੰ ਕਿਹੜੀਆਂ ਪ੍ਰੋਬਲਮ ਆਉਂਦੀਆਂ ਛੋਟੇ ਹੁੰਦਿਆਂ ਅਤੇ ਉਹਨਾਂ ਨੂੰ ਹਾਂਜੀ ਜੋ ਅੱਜ ਕੱਲ੍ਹ ਸੋਸਾਇਟੀ ਦੇ ਵਿੱਚ ਹੋ ਰਿਹਾ ਮਨ ਲੋ ਕਿ ਰੇਪ ਹੋ ਰਿਹਾ ਆ ਬੱਚੇ ਆਪਣੇ ਘਰ ਜਾ ਕੇ ਨਹੀਂ ਦੱਸਦੇ ਉਹਦੇ ਨਾਲ ਰਿਲੇਟਡ ਜੋ ਤੁਸੀਂ ਵੀਡੀਓ ਬਣਾਉਂਦੇ ਨਾ ਮੈਨੂੰ ਬਹੁਤ ਪਸੰਦ ਆਉਦੀਆਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂਜੀ ਤ ਤੁਹਾਡੀਆਂ ਵੀਡੀਓ ਜਿਆਦਾ ਗਰਲਜ਼ ਦੇ ਨਾਲ ਰਿਲੇਟਡ ਹੁੰਦੀਆਂ ਪਰ ਨੋਰਮਲ ਸੋਸਾਇਟੀ ਦੇ ਵਿੱਚ ਬੋਇਸ ਵੀ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਦੇ ਆ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਜਿਹਨੂੰ ਅਸੀਂ ਇਗਨੋਰ ਕਰ ਦਿੰਦੇ ਆ ਸਾਨੂੰ ਲੱਗਦਾ ਬੋਇਸ ਨੂੰ ਸੋਸਾਇਟੀ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀਆਂ ਐਕਚੁਅਲ ਦੇ ਵਿੱਚ ਗਰਲਸ ਦੀ ਜਿੰਨੀਆਂ ਹੀ ਪ੍ਰੋਬਲਮਸ ਬੋਇਸ ਵੀ ਕਰੀ ਬੋਇਸ ਵੀ ਫੇਸ ਕਰਦੇ ਆ ਹਾਂਜੀ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਹਾਂ ਬੋਇਜ ਕੋਈ ਪ੍ਰੋਬਲਮ ਨਹੀਂ ਕਰ ਦੇ ਵਿੱਚ ਉਹਨਾਂ ਦੇ ਮਾਇੰਡ ਵਿੱਚ ਪਾਇਆ ਜਾਂਦਾ ਕਿ ਤੁਸੀਂ ਬਹੁਤ ਸਟਰੋਂਗ ਤੁਸੀਂ ਕਦੇ ਰੋਣਾ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਮੇ ਵੀ ਉਹ ਇਹ ਹਾ ਇਹਨੂੰ ਫੀਲ ਕਰਦੇ ਸ਼ਰਮ ਮਹਿਸੂਸ ਕਰਦੇ ਕਿਸੇ ਨੂੰ ਨਹੀਂ ਦੱਸਦੇ ਬਟ ਐਕਚੁਅਲ ਵਿੱਚ ਉਹ ਵੀ ਸੇਮ ਪ੍ਰੋਬਲਮ ਗਰਲਜ਼ ਵਾਲੀਆਂ ਫੇਸ ਕਰਦੇ ਆ ਤਾਂ ਮੈੈਨੂੰ ਹਾਂਜੀ ਹਾਂਜੀ ਬਿਲਕੁਲ ਜਿਸ ਤਰਾਂ ਅਸੀਂ ਕਹਿਦੇ ਕਿ ਹਾਂ ਗਰਲਜ਼ ਦਾ ਰੇਪ ਹੋਇਆ ਐਕਚੁਅਲ ਦੇ ਵਿੱਚ ਇਹ ਵੀ ਹੋ ਸਕਦਾ ਆ ਕਿ ਬੋਇਸ ਨੂੰ ਉਸ ਚੀਜ਼ ਦੇ ਲਈ ਗਰਲਜ਼ ਨੇ ਹੀ ਐਕਚੁਅਲ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਟਰਾਈ ਕੀਤਾ ਹਾਂ ਕਿਹਾ ਹੋਵੇ ਕਿ ਹਾਂ ਉਹਨਾਂ ਨੂੰ ਕੀ ਨਹੀਂ ਇਹ ਵੀ ਰੀਜਨ ਹੋ ਸਕਦਾ ਬਟ ਐਕਚੁਅਲ ਦੇ ਵਿੱਚ ਬੋਇਸ ਵੀ ਸੇਮ ਪ੍ਰੋਬਲਮ ਫੇਸ ਕਰਦੇ ਆ ਕੁਛ ਲੇਡੀਜ ਜੋ ਉਹਨਾਂ ਨੂੰ ਪੈਸੇ ਦੇ ਕੇ ਖਰੀਦੀਆਂ ਆਂ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੀਆਂ ਆਂ ਬਿਲਕੁਲ ਤਾ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹਦੇ ਨਾਲ ਰਿਲੇਟਡ ਵੀ ਜਰੂਰ ਵੀਡੀਓ ਬਣਾਓ ਬਿਲਕੁਲ ਜਿਸ ਤਰਾਂ ਫਿਰ ਮੈਂ ਸਾਡੀ ਸੁਸਾਇਟੀ ਦੇ ਵਿੱਚ ਇੱਕ ਲੇਡੀ ਛੋਟੇ ਬੱਚੇ ਨੂੰ ਅਹਿਮ ਬੜਾ ਪੇਰੈਂਟਸ ਤੁਹਾਨੂੰ ਭੇਜ ਰਿਹਾ ਸੀ ਕਿ ਇਹ ਉਹ ਦਾ ਬੋਇਸ ਬਸ ਲੇਡੀ ਦਾ ਬੋਆਏ ਵੀ ਜਿਹੜਾ ਸੇਮ ਏਜ ਦਾ ਸੀ ਉਹਦੇ ਨਾਲ ਖੇਡਣ ਭੇਜ ਰਿਹਾ ਸੀ ਬਟ ਐਕਚੁਅਲ ਦੇ ਵਿੱਚ ਉਹ ਜਿਹੜੀ ਲੇਡੀ ਸੀ ਨਾ ਉਹਦੇ ਨਾਲ ਹਰਾਸਮੈਂਟ ਕਰ ਰਹੀ ਸੀ ਓਕੇ ਜੀ ਥੈਂਕ ਯੂ